ਹੈਲੋ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਮੈਡਮ ਮੈਂ ਉਹਨਾਂ ਦੀ ਮਾਲਕਿਨ ਬੋਲਦੀ ਹਾਂ ਮੈਡਮ ਇੱਕ ਪੇਜ ਦੇ ਦੋ ਰੁਪਏ ਲੱਗਦੇ ਨੇ ਹਾਂਜੀ ਮੈਡਮ ਕੁਆਲਿਟੀ ਵੀ ਦੋ ਤਰ੍ਹਾਂ ਦੀਆਂ ਨੇ ਇੱਕ ਤਾਂ ਸਿੰਪਲ ਹੈ ਔਰ ਇੱਕ ਜਿਹੜਾ ਵਧੀਆ ਵਿੱਚ ਹੈ ਅਤੇ ਜੇ ਤੁਸੀਂ ਸਿੰਪਲ ਕਰਵਾਉਣਾ ਚਾਹੁੰਦੇ ਉਹਦੇ ਵਿੱਚ ਤੁਹਾਨੂੰ ਦੋ ਰੁਪਏ ਪ੍ਰਤੀ ਮਿਲੂਗਾ ਔਰ ਜੇ ਤੁਸੀਂ ਵਧੀਆ ਵਿੱਚ ਕਰਵਾਉਣਾ ਚਾਹੁੰਦੇ ਹੋ ਉਸਦੇ ਵਿੱਚ ਤਿੰਨ ਰੁਪਏ ਪ੍ਰਤੀ ਮਿਲੇਗਾ ਮੈਡਮ ਬਾਈਂਡਿੰਗ ਵੀ ਤਿੰਨ ਪ੍ਰਕਾਰ ਦੀ ਹੈ ਇੱਕ ਤਾਂ ਇਹ ਕਿ ਤੁਸੀਂ ਜੇ ਸਿੰਪਲ ਕਰਵਾਉਣਾ ਚਾਹੁੰਦੇ ਉਹਦੇ 'ਚ ਦਸ ਰੁਪਏ ਨੇ ਅਤੇ ਜੇ ਤੁਸੀਂ ਨੌਰਮਲ ਵਿੱਚ ਰੱਖਣਾ ਚਾਹੁੰਦੇ ਹੋ ਉਹਦੇ ਵੀਹ ਰੁਪਏ ਨੇ ਅਤੇ ਜੇ ਤੁਸੀਂ ਪਲਾਸਟਿਕ ਵਿੱਚ ਕਰਵਾਉਣਾ ਚਾਹੁੰਦੇ ਨੇ ਤਾਂ ਉਹਨਾਂ ਵਿੱਚ ਤੀਹ ਰੁਪਏ ਨੇ ਠੀਕ ਹੈ ਮੈਡਮ ਜ਼ਰੂਰ ਧੰਨਵਾਦ ਮੈਮ ਓਕੇ ਬਾਏ